ਸਤਿ ਸ਼੍ਰੀ ਅਕਾਲ

ਹਾਂਜੀ ਹਾਂਜੀ ਉਦੋਂ ਨਾ ਮੈਂ ਥੋੜ੍ਹਾ ਸਾ ਬਾਹਰ ਗਿਆ ਸੀ ਹਾਂਜੀ ਹਾਂਜੀ ਠੀਕ ਜੇ ਇਹ ਕਿਸੇ ਨੇ ਮੋਟਰ ਚਾਲੂ ਕਰਕੇ ਛੱਡ ਤਾਂ ਨਹੀਂ ਦਿੱਤੀ ਸੀ ਜ਼ਿਆਦਾ ਦੇਰ ਠੀਕ ਜੇ ਸ਼ਾਇਦ ਮੈਂ ਪਹਿਲੇ ਵੀ ਇੱਕ ਵਾਰੀ ਆ ਕੇ ਤੁਹਾਡੀ ਮੋਟਰ ਠੀਕ ਕੀਤੀ ਸੀ ਠੀਕ ਜੇ ਠੀਕ ਜੇ ਹਾਂਜੀ ਮੈਨੂੰ ਚੱਲ ਗਿਆ ਪਤਾ ਹਾਂਜੀ ਹਾਂਜੀ ਉਹ ਕੋਈ ਗੱਲ ਨਹੀਂ ਮੈਂ ਦੇਖ ਜਾਵਾਂਗਾ ਆ ਕੇ ਉਸ ਦੇ ਨਾ ਸਟਾਟਰ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ ਮੋਟਰ ਦੇ ਹਾਂਜੀ ਹਾਂਜੀ ਠੀਕ ਜੇ ਵੈਸੇ ਮੈਂ ਹਾਲੇ ਥੋੜ੍ਹੀ ਦੇਰ ਬਾਹਰ ਆਇਆ ਹੋਇਆ ਸੀ ਕਿਤੇ ਸਾਡੀ ਕਿਤੇ ਮੀਟਿੰਗ ਚੱਲ ਰਹੀ ਸੀ ਬਿਜਲੀ ਬੋਰਡ ਵਾਲਿਆਂ ਦੀ ਅਤੇ ਫਿਰ ਮੈਂ ਅੱਧੇ ਕੁ ਘੰਟੇ ਤੱਕ ਆ ਸਕਦਾ ਠੀਕ ਜੇ ਠੀਕ ਜੇ ਮੈਂ ਕਿਹਾ ਜੇ ਜਲਦੀ ਹੈ ਤਾਂ ਫੇਰ ਆ ਜਾਵਾਂਗਾ ਜਲਦੀ ਹਾਂਜੀ ਹਾਂਜੀ ਠੀਕ ਜੀ ਕੋਈ ਗੱਲ ਨਹੀਂ ਫੇਰ ਮੈਂ ਨਾ ਮੀਟਿੰਗ ਤੋਂ ਹੁਣ ਵਿਹਲਾ ਹੋ ਕੇ ਅਤੇ ਫਿਰ ਕੱਲ ਸਵੇਰੇ ਆ ਜਾਵਾਂਗਾ ਨੌ ਕੁ ਵਜੇ ਤੱਕ

ਹਾਂਜੀ ਵੈ ਘਰ ਦਾ ਪਤਾ ਤਾਂ ਹੈ ਪਰ ਤੁਸੀਂ ਮੈਨੂੰ ਅਡਰੈਸ ਭੇਜ ਸਕਦੇ ਹੋ ਵੱਟਸਐੱਪ 'ਤੇ ਮੈਂ ਦੇਖ ਲਵਾਂਗਾ ਇੱਕ ਵਾਰੀ ਹਾਂਜੀ ਠੀਕ ਜੇ ਫਿਰ ਸਤਿ ਸ਼੍ਰੀ ਅਕਾਲ